ਹਾਂਜੀ ਕੁਦਰਤੀ ਆਫ਼ਤ ਆਈ ਸੀ ਦੋ ਜੋ ਜਿਹੜੀ ਦੋ ਹਜ਼ਾਰ ਉੱਨੀ ਵੀਹ ਦੇ ਵਿੱਚ ਆਈ ਕਰੋਨਾ ਜੋ ਕਿ ਬਹੁਤ ਭੈੜੀ ਕੁਦਰਤੀ ਆਫ਼ਤ ਸੀਗੀ ਜਿਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਨੀ ਅਤੇ ਮਾਲੀ ਇਸ ਕੁਦਰਤੀ ਆਫ਼ਤ ਕਰੋਨਾ ਦੇ ਕਾਰਣ ਬਹੁਤ ਸਾਰੀਆਂ ਜਾਨਾਂ ਵੀ ਗਈਆਂ ਅਤੇ ਪੂਰੇ ਸੰਸਾਰ ਦੇ ਵਿੱਚ ਪੂਰੀ ਦੁਨੀਆਂ ਦੇ ਵਿੱਚ ਲੋਕਡਾਊਨ ਵੀ ਲੱਗਿਆ ਜਿਸ ਨਾਲ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਨਾ ਲੋਕ ਬਾਹਰ ਜਾ ਸਕਦੇ ਸੀ ਨਾ ਲੋਕ ਬਾਹਰੋਂ ਘਰ ਆ ਸਕਦੇ ਸੀ ਇਸ ਕਰੋਨਾ ਨੇ ਲੋਕਾਂ ਦੀਆਂ ਜਾਨਾਂ ਵੀ ਲਈਆਂ ਬਹੁਤ ਸਾਰੀਆਂ ਜਾਨਾਂ ਗਈਆਂ ਦੂਸਰੀ ਕੁਦਰਤ ਆਫ਼ਤ ਆਈ ਸੀਗੀ ਦੋ ਹਜ਼ਾਰ ਤੇਈ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਭਿਆਨਕ ਮੀਂਹ ਪਿਆ ਹਨੇਰੀ ਆਈ ਝੱਖੜ ਆਇਆ ਇਸ ਭਾਰੀ ਮੀਂਹ ਨੇ ਇੰਨੀ ਤਬਾਹੀ ਮਚਾਈ ਕਿ ਬਹੁਤ ਸਾਰੀਆਂ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋਇਆ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਪੰਛੀ ਮਰ ਗਏ ਅਤੇ ਬਹੁਤ ਸਾਰੀਆਂ ਜਾਨਾਂ ਵੀ ਗਈਆਂ ਬਹੁਤ ਸਾਰੇ ਉਸਦੇ ਵਿੱਚ ਲੋਕ ਰੁੜੇ ਵੀ ਜਿਸ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਲੋਕਾਂ ਦੇ ਕੱਚੇ ਘਰ ਕਈਆਂ ਦੇ ਪੱਕੇ ਘਰ ਵੀ ਢਹਿ ਢੇਰੀ ਹੋ ਗਏ ਇਸ ਕੁਦਰਤੀ ਆਫ਼ਤ ਨੇ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਕੁਦਰਤੀ ਆਫ਼ਤਾਂ ਨੇ ਨੇ ਲੋਕਾਂ ਨੂੰ ਅਮੀਰ ਨੇ ਸਗੋਂ ਗਰੀਬ ਤੋਂ ਹੋਰ ਗਰੀਬ ਕਰ ਦਿੱਤਾ ਇਹ ਕੁਦਰਤੀ ਆਫ਼ਤ ਬਹੁਤ ਭਿਆਨਕ ਸੀ ਜੋ ਅਸੀਂ ਆਪਣੀ ਅੱਖਾਂ ਦੇ ਨਾਲ ਦੇਖੀ ਬਹੁਤ ਬਹੁਤ ਭਿਆਨਕ ਸੀ